ਮੈਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜਾਣਦੀ ਹਾਂ ਅਤੇ ਉਸ ਵਿੱਚ ਮੈਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਨੂੰ ਜਾਣਦੀ ਹਾਂ ਅਤੇ ਉਹ ਸਾਡੇ ਸਕੂਲ ਵਿੱਚ ਆ ਕੇ ਸਾਨੂੰ ਸਕੂਲ ਵਿੱਚ ਕੁੜੀਆਂ ਦੀ ਸਿੱਖਿਆ ਲਈ ਬਹੁਤ ਜ਼ਿਆਦਾ ਗਿਆਨ ਦਿੰਦੇ ਹਨ ਅਤੇ ਪ੍ਰਚਾਰ ਕਰਦੇ ਹਨ ਅਤੇ ਉਹਨਾਂ ਦਾ ਮੁੱਖ ਏਜੰਡਾ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਹੈ ਤਾਂ ਕਿ ਕੁੜੀਆਂ ਵੱਧ ਤੋਂ ਵੱਧ ਆਪਣੇ ਪੈਰਾਂ 'ਤੇ ਖੜੀਆਂ ਹੋ ਜਾਣ ਅਤੇ ਉਹ ਹਰ ਸਕੂਲ ਵਿੱਚ ਜਾ ਜਾ ਕੇ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਨਾ ਦਿੰਦੇ ਹਨ ਅਤੇ ਉਹਨਾਂ ਨੇ ਬਹੁਤ ਸਾਰੇ ਸਕੂਲ ਅਤੇ ਕੋਲਜ ਖੋਲ੍ਹੇ ਹਨ ਅਤੇ ਉਹਨਾਂ ਵਿੱਚ ਉਹਨਾਂ ਦੀ ਫੀਸ ਬਹੁਤ ਬਹੁਤ ਘੱਟ ਕੀਤੀ ਹੈ ਤਾਂ ਕਿ ਗਰੀਬ ਪਰਿਵਾਰ ਦੀ ਹਰ ਗਰੀਬ ਪਰਿਵਾਰ ਦੀ ਵੀ ਕੁੜੀ ਪੜ੍ਹ ਸਕੇ ਅਤੇ ਹਰ ਕੁੜੀ ਪ ਵੱਧ ਤੋਂ ਵੱਧ ਪੜ੍ਹੇ ਅਤੇ ਕੁਝ ਕੰਮ ਲੱਗੇ ਅਤੇ ਆਪਣੇ ਪੈਰਾਂ ਸਿਰ ਹੋ ਜੇ ਅਤੇ ਉਹਨਾਂ ਲਈ ਉਹਨਾਂ ਨੇ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਉਹਨਾਂ ਨੇ ਗਤੀਵਿਧੀਆਂ ਕੀਤੀਆਂ ਹਨ ਅਤੇ ਹੋਰ ਵੀ ਜ਼ਿਆਦਾ ਕੁਝ ਚੀਜ਼ਾਂ ਉਹਨਾਂ ਨੂੰ ਐਕਸਟਰਾ ਉਹਨਾਂ ਨੂੰ ਜ਼ਿਆਦਾ ਕਰਨ ਲਈ ਦਿੱਤੀਆਂ ਹਨ ਜਿਵੇਂ ਉਹਨਾਂ ਨੂੰ ਸਿਖਲਾਈ ਦਾ ਕੰਮ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਪੜ੍ਹਾਇਆ ਉਹਨਾਂ ਨੂੰ ਕੁਕਿੰਗ ਦਾ ਕੰਮ ਖਾਣਾ ਪਕਾਉਣ ਦਾ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਅਗਾਂਹ ਕਿਵੇਂ ਬੋਲਣਾ ਹੈ ਕਿਵੇਂ ਰਹਿਣਾ ਹੈ ਸਭ ਕੁਝ ਸਿਖਾਇਆ ਜਾਂਦਾ ਹੈ ਅਤੇ ਉਸ ਉਹਨਾਂ ਲਈ ਉਹਨਾਂ ਨੇ ਯਾਤਰਾ ਫਰੀ ਕੀਤੀ ਹੈ ਤਾਂ ਕਿ ਕੁੜੀਆਂ ਰਾਤ ਨੂੰ ਵਧੀਆ ਅ ਰਾਤ ਨੂੰ ਅੰਧੇਰੀ ਰਾ ਅੰਧੇਰੀ ਰਾਤ 'ਚ ਸੇਫ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ ਅਤੇ ਅਕੇਲੇ ਜਾਣ 'ਤੇ ਸਫ਼ਰ ਕਰਨ ਵਿੱਚ ਉਹ ਡਰ ਨਾ ਫੀਲ ਕਰਨ ਤਾਂ ਉਹਨਾਂ ਨੂੰ ਹਮੇਸ਼ਾ ਹੀ ਸੁਰੱਖਿਅਤ ਫੀਲ ਹੋਵੇ ਅਤੇ ਅਤੇ ਵੱਧ ਤੋਂ ਵੱਧ ਕੁੜੀਆਂ ਨੂੰ ਪੜ੍ਹਾਉਣ ਦਾ ਉਹਨਾਂ ਨੇ ਹਰ ਤਰ੍ਹਾਂ ਪ੍ਰਚਾਰ ਕੀਤਾ ਹੈ ਅਤੇ ਉਹ ਅੱਜ ਵੀ ਅ ਵੱਧ ਤੋਂ ਵੱਧ ਕੁੜੀਆਂ ਪੜ੍ਹਾਉਣ ਅਤੇ ਕੁੜੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ